ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਤੇਜਪਾਲਜੀਤ ਸਿੰਘ ਆ ਅਤੇ ਭਾਰਤ ਵਿੱਚ ਬਹੁਤੀਆਂ ਪ੍ਰਸਿੱਧ ਖੇਡਾਂ ਖੇਡੀਆਂ ਜਾਂਦੀਆਂ ਹਨ ਪਰ ਕੁਝ ਸਭ ਤੋਂ ਪ੍ਰਸਿੱਧ ਖੇਡਾਂ ਹਨ ਜਿਵੇਂ ਕਿ ਕ੍ਰਿਕਟ ਅਤੇ ਹਾਕੀ ਅਤੇ ਫੁੱਟਬਾਲ ਇਹੋ ਜਿਹੀਆਂ ਖੇਡਾਂ ਜਿਹੜੀਆਂ ਕਿ ਭਾਰਤ ਵਿੱਚ ਬਹੁਤ ਪ੍ਰਸਿੱਧ ਹਨ ਅਤੇ ਬਹੁਤ ਜ਼ਿਆਦਾ ਖੇਡੀ ਜਾਂਦੀਆਂ ਹਨ ਬੱਚੇ ਜਾਂ ਜਵਾਨ ਲੋਕ ਬਜ਼ੁਰਗ ਤੱਕ ਕਈ ਇਹਨਾਂ ਨੂੰ ਬਹੁਤ ਪਸੰਦ ਕਰਦੇ ਹਨ ਇਹ ਖੇਡਾਂ ਨੂੰ ਖੇਡਣਾ ਅਤੇ ਕ੍ਰਿਕਟ ਤਾਂ ਬਹੁਤ ਹੀ ਪ੍ਰਸਿੱਧ ਖੇਡ ਹੈ ਸਾਡੇ ਦੇਸ਼ ਦੀ ਭਾਰਤ ਦੀ ਅਤੇ ਇਹਦੇ ਇਹ ਖੇਡਾਂ ਇਸ ਕਰਕੇ ਜ਼ਿਆਦਾ ਪ੍ਰਸਿੱਧ ਹੁੰਦੀਆਂ ਕਿਉਂਕਿ ਇਹ ਜਿਹੜੇ ਬਹੁਤ ਤਗੜੇ ਤਗੜੇ ਬਹੁਤ ਵੱਡੇ ਵੱਡੇ ਖਿਡਾਰੀ ਜਾਂ ਅਥਲੀਟ ਕਹਿ ਲਉ ਜਿਨ੍ਹਾਂ ਨੂੰ ਉਹ ਖੇਡਦੇ ਆ ਤਾਂ ਕਰਕੇ ਖੇਡਾਂ ਬਹੁਤ ਮਸ਼ਹੂਰ ਹੁੰਦੀਆਂ ਜਿੱਦਾਂ ਕ੍ਰਿਕਟ ਬਹੁਤ ਮਸ਼ਹੂਰ ਹੈ ਕਿਉਂਕਿ ਇੱਥੇ ਵਿਰਾਟ ਕੋਹਲੀ ਰੋਹਿਤ ਸ਼ਰਮਾ ਵਰਗੇ ਕਈ ਪਲੇਅਰ ਜਿਹੜੇ ਹੈਗੇ ਉਹ ਖੇਡਦੇ ਆ ਅਤੇ ਫੁੱਟਬਾਲ ਵੀ ਬਹੁਤ ਪਲੇਅਰ ਕਿਉਂਕਿ ਇੱਥੇ ਬਹੁਤ ਬਹੁਤ ਮੁਸ਼ ਬਹੁਤ ਬਹੁਤ ਤਕੜੇ ਵੱਡੇ ਵੱਡੇ ਖਿਡਾਰੀ ਖੇਡਦੇ ਜਿੰਨੇ ਜਿਵੇਂ ਕਿ ਸੁਨੀਲ ਛੇਤਰੀ ਹੈਗਾ ਵਾ ਉਹ ਖੇਡਦਾ ਵਾ ਅਤੇ ਬਾਕੀ ਵੀ ਜਿਵੇਂ ਕਿ ਰੈਸਲਿੰਗ ਜਿੱਦਾਂ ਗੀਤਾ ਕੁਮਾਰੀ ਫੋਗਾਟ ਬਹੁਤ ਜਿਹੇ ਇਹੋ ਜਿਹੇ ਪਲੇਅਰ ਆ ਜਿਨ੍ਹਾਂ ਕਰਕੇ ਖੇਡਾਂ ਮਸ਼ਹੂਰ ਹਨ ਅਤੇ ਇਹ ਖੇਡਾਂ ਪੂਰੇ ਪੰ ਪੂਰੇ ਦੇਸ਼ ਵਿੱਚ ਖੇਡੀਆਂ ਜਾਂਦੀਆਂ ਹਨ ਅਤੇ ਲੋਕ ਇਹਨਾਂ ਖੇਡਾ ਨੂੰ ਬਹੁਤ ਪਸੰਦ ਕਰਦੇ ਹਨ ਇਹ ਖੇਡਾਂ ਖੇਡਾਂ ਨਾਲ ਸਰੀਰਿਕ ਤੰਦਰੁਸਤੀ ਰਹਿੰਦੀ ਹੈ ਮਨ ਸ਼ਾਂਤ ਰਹਿੰਦਾ ਹੈ ਇੱਕਦਮ ਸਰੀਰ ਬਹੁਤ ਵਧੀਆ ਰਹਿੰਦਾ ਹੈ ਫਿਟਨੈਸ ਰਹਿੰਦੀ ਹੈ ਸਰੀਰ ਨੂੰ ਅਤੇ ਇਹ ਅਥਲੀਟ ਜਿਹੜੇ ਹਨ ਜਿਨ੍ਹਾਂ ਕਰਕੇ ਦ ਇਹ ਖੇਡਾਂ ਪ੍ਰਸਿੱਧ ਹਨ ਇਸ ਕਰਕੇ ਹੀ ਸਾਡਾ ਭਾਰਤ ਜਨ ਦੇਸ਼ਾਂ ਤੋਂ ਬਹੁਤ ਵਧੀਆ ਹੈ ਅਤੇ ਸਾਨੂੰ ਫਕਰ ਹੋਣਾ ਚਾਹੀਦਾ ਹੈ ਕਿ ਅਸੀਂ ਭਾਰਤੀ ਹਾਂ ਧੰਨਵਾਦ